ਵੈਸੇ ਤਾਂ ਮੇਰੇ ਮਨ ਪਸੰਦ ਭੋਜਨ ਬਹੁਤ ਸਾਰੇ ਹਨ ਪਰ ਮੇਰਾ ਸਭ ਤੋਂ ਮਨ ਪਸੰਦ ਭੋਜਨ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਹੈ ਇਸ ਨੂੰ ਬਣਾਉਣ ਵਿੱਚ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਲੱਗ ਜਾਂਦਾ ਹੈ ਇਹ ਜ਼ਿਆਦਾਤਰ ਸਰਦੀ ਦੇ ਮੌਸਮ ਵਿੱਚ ਬਣਾਇਆ ਜਾਂਦਾ ਹੈ ਅਤੇ ਲੋਕ ਸਰਦੀ ਦੇ ਮੌਸਮ ਵਿੱਚ ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਹੀ ਰੋਟੀ ਜ਼ਿਆਦਾ ਖਾਂਦੇ ਹਨ ਅਤੇ ਇਹ ਪੰਜਾਬ ਦਾ ਭੋਜਨ ਹੈ ਅਤੇ ਇਸ ਨੂੰ ਹੁਣ ਪੂਰੇ ਵਰਲਡ ਵਿੱਚ ਬਣਾਇਆ ਜਾਂਦਾ ਹੈ ਜੇ ਇਸਨੂੰ ਖਾਣੇ ਦੀ ਗੱਲ ਕਰੀ ਜਾਵੇ ਤਾਂ ਇਸਨੂੰ ਮੈਂ ਆਪਣੇ ਘਰ ਵਿੱਚ ਹੀ ਖਾਣਾ ਜ਼ਿਆਦਾ ਪਸੰਦ ਕਰਦਾ ਹਾਂ ਅਤੇ ਮੈਨੂੰ ਘਰ ਵਿੱਚ ਬਣਿਆ ਸਾਗ ਹੀ ਜ਼ਿਆਦਾ ਪਸੰਦ ਅਤੇ ਸਵਾਦਿਸ਼ਟ ਲੱਗਦਾ ਹੈ ਜਦੋਂ ਮੈਨੂੰ ਭੁੱਖ ਵੀ ਨਹੀਂ ਹੁੰਦੀ ਤਾਂ ਮੈਨੂੰ ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਦੇਖ ਕੇ ਹੀ ਜ਼ਿਆਦਾ ਭੁੱਖ ਲੱਗ ਜਾਂਦੀ ਆ ਅਤੇ ਜਦੋਂ ਮੈਂ ਭੋਜਨ ਖਾਂਦਾ ਹਾਂ ਤਾਂ ਮੈਂ ਸਰ੍ਹੋਂ ਦੇ ਸਾਗ ਵਿੱਚ ਮੱਖਣ ਜਾਂ ਦੇਸੀ ਘਿਓ ਪਾ ਕੇ ਨਾਲ ਲੱਸੀ ਦੇ ਖਾਣਾ ਪਸੰਦ ਕਰਦਾ ਹਾਂ